ਮੈਂ ਦਿੱਲੀ ਜਾਣ ਵਾਸਤੇ ਇੱਕ ਕੈਬ ਬੁੱਕ ਕਰਵਾਈ ਸੀ ਜਿਸ ਦਾ ਮੈਂ ਭੁਗਤਾਨ ਆਪਣੇ ਬੈਂਕ ਖਾਤੇ ਵਿੱਚੋਂ ਕੀਤਾ ਸੀ ਹੈ ਨਾ ਅਤੇ ਬਟ ਪਰ ਮੈਂ ਕਿਸੇ ਕਾਰਨ ਦਿੱਲੀ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਕੈੈਂਸਲ ਕਰਨ ਦਾ ਕਾਰਨ ਮੇਰਾ ਇਹ ਸੀਗਾ ਕਿ ਮੈਂ ਜਿਸ ਕਾਰਨ ਜਾਣਾ ਸੀਗਾ ਉਹ ਉਹਦਾ ਉਹ ਮੈਂ ਬਾਅਦ ਵਿੱਚ ਟ੍ਰੇਨ ਰਾਹੀਂ ਜਾਣਾ ਜ਼ਿਆਦਾ ਜ਼ਰੂਰੀ ਸਮਝਿਆ ਅਤੇ ਹੁਣ ਮੈਂ ਉਸ ਏਜੰਸੀ ਨੂੰ ਕੈਬ ਏਜੰਸੀ ਨੂੰ ਡਰਾਈਵਰ ਨੂੰ ਕੈਬ ਏਜੰਸੀ ਨੂੰ ਵੀ ਅਤੇ ਡਰਾਈਵਰ ਨੂੰ ਵੀ ਈ ਪੈਸੇ ਪੇਅ ਕੀਤੇ ਸੀਗੇ ਪੈਸੇ ਦਿੱਤੇ ਸੀਗੇ ਜਿਹਦੇ ਵਿੱਚ ਮੇਰਾ ਉਹਨਾਂ ਨੂੰ ਏਜੰਸੀ ਨੂੰ ਤਿੰਨ ਹਜ਼ਾਰ ਅਤੇ ਡਰਾਈਵਰ ਨੂੰ ਇੱਕ ਹਜ਼ਾਰ ਪੇਅ ਕੀਤਾ ਸੀ ਜਿਹੜਾ ਮੈਂ ਹੁਣ ਕੈਬ ਰੱਦ ਕਰਨ ਦੇ ਕਾਰਨ ਵਾਪਸ ਚਾਹੁੰਦੀ ਹਾਂ ਤੁਸੀਂ ਇਹ ਭੇਜ ਕੇ ਮੈਨੂੰ ਜਾਂ ਤਾਂ ਮੇਰੇ ਬੈਂਕ ਅਕਾਊਟ ਵਿੱਚ ਵਾ ਪਾ ਦਿਓ ਜਾਂ ਮੈਨੂੰ ਗੂਗਲ ਪੇਅ ਜਾਂ ਪੇਅਟੀਐੱਮ ਰਾਹੀਂ ਵਾਪਸ ਕਰ ਸਕਦੇ ਹੋ ਇਹ ਤੁਹਾਡੀ ਆਪਣੀ ਇੱਛਾ ਹੈ ਅਤੇ ਤੁਸੀਂ ਇ ਇਹ ਮੈਨੂੰ ਮੇਰੇ ਬੈਂਕ ਖਾਤੇ ਵਿੱਚ ਵੀ ਰਿਫੰਡ ਕਰ ਸਕਦੇ ਹੋ ਮੈਂ ਤੁਹਾਨੂੰ ਆਪਣਾ ਰੀਜ਼ਨ ਦੱਸ ਰਹੀ ਹਾਂ ਕਿ ਮੈਂ ਕਿਉਂ ਨਹੀਂ ਗਈ ਮੈਂ ਟ੍ਰੇਨ ਰਾਹੀਂ ਉਹਨਾਂ ਦਿਨਾਂ ਵਿੱਚ ਕਿਸਾਨ ਅੰਦੋਲਨ ਦਾ ਕਰਕੇ ਟ੍ਰੇਨ ਰਾਹੀਂ ਜਾਣਾ ਜ਼ਿਆਦਾ ਬੈਟਰ ਸਮਝਿਆ ਤਾਂ ਕਿਰਪਾ ਕਰਕੇ ਮੇਰਾ ਉਹ ਭੁਗਤਾਨ ਵਾਪਸ ਕੀਤਾ ਜਾਏ ਧੰਨਵਾਦ